ਵੈਸੇ ਤਾਂ ਗੱਲ ਕੀਤੀ ਜਾਵੇ ਕਿ ਵੱਖ ਵੱਖ ਭਾਸ਼ਾਵਾਂ ਮੈਂ ਇੰਗਲਿਸ਼ ਦਾ ਜਿਹੜਾ ਸੌਂਗ ਹੈ ਬੇਬੀ ਬੇਬੀ ਸੌਂਗ ਜਿਹਨੂੰ ਕਿ ਜਸਟਿਨ ਬੀਬਰ ਨੇ ਲਿਖਿਆ ਹੋਇਆ ਏ ਉਹ ਗਾਣਾ ਮੈਂ ਬਹੁਤ ਸੁਣਨਾ ਅਤੇ ਗਾਉਣਾ ਪਸੰਦ ਕਰਦਾ ਹਾਂ ਅਤੇ ਆਪਣੇ ਅੱਜ ਕੱਲ੍ਹ ਦੇ ਕਈ ਇਹੋ ਜਿਹੇ ਸਿੰਗਰ ਕਲਾਕਾਰ ਆ ਚੁੱਕੇ ਹਨ ਜਿਵੇਂ ਕਿ ਸਿੱਧੂ ਮੂਸੇਆਲਾ ਮੈਂ ਉਹਨਾਂ ਦੇ ਗਾਣੇ ਵੀ ਬਹੁਤ ਸੁਣਨੇ ਅਤੇ ਗਾਉਣੇ ਪਸੰਦ ਕਰਦਾ ਹਾਂ